ਜੀ ਹਾਂ ਮੈਂ ਰੋਜ਼ ਫੇਸਬੁੱਕ ਟਵਿੱਟਰ ਜਾਂ ਇੰਸਟਾਗ੍ਰਾਮ ਦੀ ਵਰਤੋਂ ਕਰਦੀ ਹਾਂ ਮੈਂ ਇੱਕ ਡਿਜ਼ਾਈਨਰ ਹਾਂ ਅਤੇ ਮੇਰਾ ਰੋਜ਼ ਦਾ ਕੰਮ ਹੈ ਸੋਸ਼ਲ ਮੀਡੀਆ 'ਤੇ ਕੰਮ ਕਰਨਾ ਮੈਂ ਉਹਦੇ ਵਿੱਚ ਇਮੀਗ੍ਰੇਸ਼ਨ ਰਿਲੇਟਿਡ ਆ ਕਿਸੇ ਦੀ ਜੁਐਲਰੀ ਦਾ ਕੰਮ ਆ ਅਤੇ ਉਸ ਤੋਂ ਰਿਲੇਟਿਡ ਪੋਸਟ ਪੋਸਟ ਕਰਦੀ ਹਾਂ ਅਤੇ ਮੈਂ ਮੁਮ ਮੋਸਟਲੀ ਮੈਂ ਆਪਣਾ ਆਪਣੇ ਦਿਨ 'ਚੋਂ ਸਤਾਰਾਂ ਜਾਂ ਅਠਾਰਾਂ ਘੰਟੇ ਮੈਂ ਸੋਸ਼ਲ ਮੀਡੀਆ 'ਤੇ ਹੀ ਹੁੰਦੀ ਹਾਂ ਕਿਉਂਕਿ ਮੇਰਾ ਸਾਰਾ ਕੰਮ ਉੱਥੇ ਹੀ ਹੈਗਾ ਹੈ ਅਤੇ ਮੈਂ ਇਸ ਬਾਰੇ ਇਹ ਚੀਜ਼ ਪਸੰਦ ਕਰਦੀ ਹਾਂ ਕਿ ਅਸੀਂ ਕਿਸੇ ਨਾਲ ਵੀ ਕਦੀ ਵੀ ਕੋਂਟੈਕਟ ਕਰ ਸਕਦੇ ਹਾਂ ਇਹ ਸਾਨੂੰ ਇੱਕ ਅਜਿਹੀ ਅਜਿਹਾ ਲਾਭ ਦਿੰਦਾ ਹੈ ਕਿ ਅਸੀਂ ਕਿਤੇ ਵੀ ਬੈਠੇ ਕਿਸੇ ਵੀ ਇਨਸਾਨ ਨਾਲ ਡਾਇਰੈਕਟ ਗੱਲ ਕਰ ਸਕਦੇ ਹਾਂ ਉਸਨੂੰ ਆਪਣੇ ਕੰਮ ਬਾਰੇ ਦੱਸ ਸਕਦੇ ਹਾਂ ਅਸੀਂ ਔਨਲਾਈਨ ਉਹਦੇ ਨਾਲ ਕੰਮ ਕਰ ਸਕਦੇ ਹਾਂ ਅਸੀਂ ਕਿਸੇ ਬਾਰੇ ਕੁਛ ਜਾਣਕਾਰੀ ਚਾਹੁੰਦੇ ਹਾਂ ਜਾਂ ਕਿਸੇ ਨੂੰ ਮਿਲਣਾ ਚਾਹੁੰਦੇ ਹਾਂ ਅਤੇ ਅਸੀਂ ਉੱਥੇ ਵੀਡੀਓ ਕੋਲ ਕੋਲ ਕਰਕੇ ਹੀ ਉਸ ਬਾਰੇ ਗੱਲ ਕਰ ਸਕਦੇ ਹਾਂ ਜਿੱਦਾਂ ਅੱਜ ਕੱਲ੍ਹ ਬਹੁਤ ਸਾਰੇ ਇੰਨਫੀਊਲੈਂਸਰਸ ਨੇ ਕ੍ਰੀਏਟਰਸ ਨੇ ਉਹ ਆਪਣੇ ਕੋਂਟੈਂਟ ਨੂੰ ਉੱਥੇ ਪਾਉਂਦੇ ਹਨ ਅਤੇ ਲੋਕੀਂ ਉਸ ਚੀਜ਼ ਨੂੰ ਪਸੰਦ ਕਰਦੇ ਹਨ ਅੱਜ ਕੱਲ੍ਹ ਸੋਸ਼ਲ ਮੀਡੀਆ ਬਹੁਤ ਜ਼ਿਆਦਾ ਜ਼ਰੂਰੀ ਹੋ ਗਿਆ ਹੈ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਕਿਉਂਕਿ ਉੱਥੇ ਸਾਨੂੰ ਹਰ ਚੀਜ਼ ਦੀ ਇਨਫੋਰਮੇਸ਼ਨ ਦਿੱਤੀ ਜਾਂਦੀ ਹੈ ਸਾਨੂੰ ਇਹ ਦੱਸਿਆ ਜਾਂਦਾ ਹੈ ਕਿ ਸਾਡੇ ਲਈ ਕੀ ਚੰਗਾ ਹੈ ਅਤੇ ਕੀ ਨਹੀਂ ਉੱਥੇ ਸਾਨੂੰ ਹਰ ਚੀਜ਼ ਨੂੰ ਰਿਲੇਟਿਡ ਆਪਣੀ ਪੜ੍ਹਾਈ ਨੂੰ ਲੈ ਕੇ ਆਪਣੇ ਵਰਕਿੰਗ ਲਾਈਫ ਨੂੰ ਲੈ ਕੇ ਸਾਨੂੰ ਹਰ ਚੀਜ਼ ਨੂੰ ਲੈ ਕੇ ਉੱਥੇ ਸਾਨੂੰ ਜਾਣਕਾਰੀ ਮਿਲ ਸਕਦੀ ਹੈ ਜਾਂ ਆਪਣੇ ਆਈਡੀਅਲਸ ਨੂੰ ਫੋਲੋ ਕਰ ਸਕਦੇ ਹਾਂ ਉੱਥੇ ਉਹਨਾਂ ਦੀ ਜ਼ਿੰਦਗੀ ਨੂੰ ਦੇਖ ਸਕਦੇ ਹਾਂ ਅਤੇ ਇਸ ਬਾਰੇ ਬਸ ਮੈਨੂੰ ਇੱਕੋ ਗੱਲ ਨਾਪਸੰਦ ਹੈ ਕਿ ਇਹਦੇ ਕਾਰਨ ਇੱਕ ਬੰਦਾ ਜੋ ਹੈ ਉਹ ਇਹਦਾ ਅਡਿਕਟ ਹੋ ਜਾਂਦਾ ਹੈ ਉਹਨੂੰ ਬਸ ਪੂਰਾ ਦਿਨ ਸੋਸ਼ਲ ਮੀਡੀਆ ਹੀ ਚਾਹੀਦਾ ਹੈ ਇਸ ਤੋਂ ਇਲਾਵਾ ਮੈਨੂੰ ਨਹੀਂ ਲੱਗਦਾ ਕਿ ਸੋਸ਼ਲ ਮੀਡੀਆ ਦੇ ਵਿੱਚ ਕੋਈ ਵੀ ਇੱਦਾਂ ਦੀ ਚੀਜ਼ ਹੈ ਜੋ ਲੋਕੀਂ ਨਾਪਸੰਦ ਕਰਨਗੇ